ਮੈਂ ਔਨਲਾਈਨ ਚਾਦਰਾਂ ਦਾ ਔਡਰ ਕੀਤਾ ਔਡਰ ਮੈਨੂੰ ਸਮੇਂ 'ਤੇ ਹੀ ਡਿਲੀਵਰ ਕਰ ਦਿੱਤਾ ਗਿਆ ਸੀ ਚਾਦਰਾਂ ਦੀ ਕੀਮਤ ਬਹੁਤ ਹੀ ਘੱਟ ਸੀ ਅਤੇ ਚਾਦਰਾਂ ਦੀ ਈ ਕੁਆਲਿਟੀ ਬਹੁਤ ਹੀ ਵਧੀਆ ਸੀ ਮੈਨੇ ਚਾਰ ਅਲੱਗ ਰੰਗਾਂ ਦੀਆਂ ਚਾਦਰਾਂ ਦਾ ਔਡਰ ਕੀਤਾ ਸੀ ਜਿਸ ਵਿੱਚ ਮੈਨੇ ਲਾਲ ਹਰਾ ਨੀਲਾ ਅਤੇ ਸਫੇਦ ਰੰਗ ਦਾ ਔਡਰ ਕੀਤਾ ਸੀ ਚਾਦਰਾਂ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ ਚਾਦਰਾਂ ਦੀ ਲੰਬਾਈ ਅਤੇ ਚੌੜਾਈ ਮੇਰੇ ਬਿਸਤਰੇ ਦੇ ਅਨੁਸਾਰ ਹੀ ਸੀ ਚਾਂਦਰਾਂ ਉੱਤੇ ਵਧੀਆ ਚਿੱਤਰਕਾਰੀ ਕੀਤੀ ਗਈ ਸੀ ਚਾਦਰਾਂ ਦੇ ਨਾਲ ਨਾਲ ਸਿਰਾਣਿਆਂ ਦੇ ਕਬਰ ਵੀ ਸਨ ਜੋ ਕਿ ਬਹੁਤ ਹੀ ਸੁੰਦਰ ਲੱਗ ਰਹੇ ਸਨ ਚਾਦਰਾਂ ਦੇ ਨਾਲ ਨਾਲ ਸਿਰਾਣਿਆਂ ਦੇ ਕਵਰ ਦਾ ਵੀ ਰੰਗ ਬਹੁਤ ਹੀ ਵਧੀਆ ਲੱਗ ਰਿਹਾ ਸੀ ਸਾਰਿਆਂ ਦੇ ਉੱਪਰ ਵਧੀਆ ਹੀ ਚਿੱਤਰਕਾਰੀ ਕੀਤੀ ਗਈ ਸੀ ਅਤੇ ਸਿਰਾਣਿਆਂ ਦੇ ਕਵਰ ਦੇ ਉੱਪਰ ਜਿੱਪਾਂ ਵੀ ਲੱਗੀਆਂ ਹੋਈਆਂ ਸਨ ਹਰੇਕ ਚਾਦਰ ਦੇ ਦਾ ਰੰਗ ਅਤੇ ਚਿੱਤਰ ਵਧੀਆ ਵਧੀਆ ਬਣੇ ਹੋਏ ਸਨ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਧੋਣ ਤੋਂ ਬਾਅਦ ਚਾਦਰਾਂ ਦਾ ਰੰਗ ਚਲਾ ਜਾਂਦਾ ਹੈ ਪਰ ਜਿਹੜੀਆਂ ਚਾਦਰਾਂ ਮੈਂ ਔਡਰ ਕੀਤੀਆਂ ਸੀ ਉਹਨਾਂ ਦਾ ਰੰਗ ਨਹੀਂ ਗਿਆ ਅਤੇ ਉਹ ਧੋਣ ਤੋਂ ਬਾਅਦ ਹੋਰ ਵੀ ਸੁੰਦਰ ਅਤੇ ਮੁਲਾਇਮ ਦਿਖ ਰਹੀਆਂ ਸਨ ਚਾਦਰਾਂ ਦੀ ਕੁਆਲਿਟੀ ਬਹੁਤ ਹੀ ਅੱਛੀ ਸੀ ਮੈਨੂੰ ਇਹ ਔਡਰ ਬਹੁਤ ਹੀ ਵਧੀਆ ਲੱਗ ਰਿਹਾ ਸੀ ਅਤੇ ਇਸ ਦੀ ਕੀਮਤ ਵੀ ਬਹੁਤ ਵਧੀਆ ਸੀ